ਹੈਲੋ ਹਾਂ ਪਾਰਸ ਵਧੀਆ ਪਾਰਸ ਤੂੰ ਸੁਣਾ ਕੀ ਹਾਲ ਆ ਹਾਂ ਸਭ ਵਧੀਆ ਅਤੇ ਯਾਰ ਮੈਂ ਨਾ ਪੁੱਛਣਾ ਸੀ ਮੈਂ ਨਾ ਦਿੱਲੀ ਤੋਂ ਅੰਮ੍ਰਿਤਸਰ ਸ਼ਿਫਟ ਹੋ ਗਿਆ ਅਤੇ ਮੈਂ ਨਾ ਆਪਣੀ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਚੇਂਜ ਕਰਵਾਉਣਾ ਸੀ ਅਤੇ ਕਿੱਦਾਂ ਕਰਵਾਇਆ ਜਾਵੇ ਅੱਛਾ ਅੱਛਾ ਹਾਂ ਉਹ ਤਾਂ ਹੈ ਮੈਂ ਤਾਂ ਹੀ ਤੈਨੂੰ ਪੁੱਛਦਾ ਪਿਆ ਸੀ ਅੱਛਾ ਅਤੇ ਫਿਰ ਤੂੰ ਫ੍ਰੀ ਹਾਂ ਅਤੇ ਆਪਾਂ ਪਰਸੋਂ ਚੱਲ ਪਈਏ ਦੋਨੇਂ ਜਾਣੇ ਹਾਂ ਅਤੇ ਵੈਸੇ ਲਾਗੇ ਕੇ ਦੂਰ ਹਾਂ ਚੱਲ ਠੀਕ ਆ ਪਰਸੋਂ ਮਿਲਦੇ ਆਪਾਂ ਠੀਕ ਹੈ ਓਕੇ